ਦੋ ਸੌ ਚਾਰ ਪੰਜ ਸੌ ਸੱਤ ਨੌ ਸੌ ਉੱਨੀ ਦੋ ਹਜ਼ਾਰ ਚਾਰ ਸੌ ਵੀਹ ਤਿੰਨ ਹਜ਼ਾਰ ਤਿੰਨ ਸੌ ਚੌਵੀ ਤਿੰਨ ਸੌ ਇੱਕ ਸੱਤ ਸੌ ਸਤਾਈ ਦੋ ਸੌ ਅੱਠ ਅੱਠ ਸੌ ਦੋ ਛੇ ਸੌ ਅਠੱਤੀ